ਧੰਨਵਾਦ ਵੀਰ ਜੀ ਤੁਸੀਂ ਇਸ ਸਮੇਂ ਮੈਨੂੰ ਮੇਰੇ ਘਰ ਤੱਕ ਛੱਡਿਆ ਰਾਤ ਦਾ ਟਾਈਮ ਸੀ ਮੈਨੂੰ ਕੋਈ ਵੀ ਓਟੋ ਜਾਂ ਕੁਛ ਵੀ ਨਹੀਂ ਮਿਲ ਰਿਹਾ ਸੀ ਅਤੇ ਜਦੋਂ ਤੁਹਾਡੀ ਉਹ ਕੈਬ ਮਿਲੀ ਤਾਂ ਮੈਨੂੰ ਪਹਿਲਾਂ ਡਰ ਲੱਗ ਰਿਹਾ ਸੀਗਾ ਬੈਠਣ ਤੋਂ ਪਰ ਤੁਹਾਡੇ ਬਿਹੇਵੀਅਰ ਤੋਂ ਤੁਹਾਡੇ ਸੁਭਾਅ ਤੋਂ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦੀ ਹਾਂ